ਭੰਗੜੇ ਦੀ ਮਹੱਤਤਾ ਬਾਰੇ ਸਾਨੂੰ ਕੀ ਦੱਸੀਏ ਕਿਉਂਕਿ ਪੰਜਾਬ ਵਿੱਚ ਭੰਗੜੇ ਦੀ ਕੋਈ ਮਹੱਤਤਾ ਹੀ ਨਹੀਂ ਸੋਗ ਇਹ ਪੂਰਾ ਇੱਕ ਤਿਹਾਰ ਹੀ ਐ ਭੰਗੜਾ ਕਿਉਂਕੀ ਭੰਗੜਾ ਪੰਜਾਬੀ ਸਭਿਆਚਾਰ ਦਾ ਪ੍ਰਤੀਕ ਅਤੇ ਦਿਹਾਰ ਦਾ ਨਿਖੜ ਵਾਂਗ ਹੈ ਪੰਜਾਬੀ ਸੱਭਿਆਚਾਰ ਵਿੱਚ ਜਦ ਵੀ ਕਿਤੇ ਖੁਸ਼ੀ ਗਮੀ ਹੁੰਦੀ ਹੈ ਤੇ ਇਹ ਨਾਚ ਕੀਤਾ ਜਾਂਦਾ ਨਾ ਹੈ ਨਾ ਸਿਰਫ ਇੱਕ ਨਾਚ ਸਗੋਂ ਖੁਸ਼ੀ ਅਤੇ ਸਾਹ ਵਿੱਚ ਜੀਵਨ ਦੇ ਜਸ਼ਨ ਦਾ ਪ੍ਰਤੀਕ ਵੀ ਹੈ ਆਓ ਦੇਖੀਏ ਕਿ ਭੰਗੜਾ ਪੰਜਾਬੀ ਸੱਭਿਆਚਾਰ ਵਿੱਚ ਹੀ ਪ੍ਰਚਲਿਤ ਨਹੀਂ ਹੈ ਜਦਕਿ ਦੁਨੀਆ ਭਰ ਵਿੱਚ ਹੀ ਮਨਾਇਆ ਜਾਂਦਾ ਹੈ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਭੰਗੜਾ ਸਿਰਫ ਨਾ ਕੀ ਪੰਜਾਬ ਵਿੱਚ ਪਾਇਆ ਜਾਂਦਾ ਸਗੋਂ ਇਹ ਪਾਕਿਸਤਾਨ ਵਿੱਚ ਹੀ ਪਾਇਆ ਜਾਂਦਾ ਅੱਜ ਕੱਲ ਤੱਕ ਕਨੇਡਾ ਵਿੱਚ ਵੀ ਬਹੁਤ ਹੀ ਜਿਆਦਾ ਮਾਤਰਾ ਵਿੱਚ ਭੰਗੜਾ ਪਾਇਆ ਜਾਂਦਾ ਕਿਉਂਕਿ ਬਹੁਤ ਜਿਆਦਾ ਪੰਜਾਬੀ ਅੱਜ ਕੱਲ ਬਾਹਰਲੇ ਮੁਲਕਾਂ ਵਿੱਚ ਵੱਸ ਚੁੱਕੇ ਹਨ ਜਿਆਦਾਤਰ ਦੁਨੀਆਂ ਵਿੱਚ ਪਾਕਿਸਤਾਨ ਅਤੇ ਕਨੇਡਾ ਪੰਜਾਬ ਵਿੱਚ ਹੀ ਭੰਗੜਾ ਪਾਇਆ ਜਾਂਦਾ ਕਿਉਂਕਿ ਲੋਕਾਂ ਦਾ ਮੰਨਨਾ ਕਿ ਇਹ ਇੱਕ ਖੁਸ਼ੀ ਦਾ ਪ੍ਰਗਟਾਵਾ ਕਰਨਾ ਸਾਧਨ ਹੈ ਭੰਗੜਾ ਖੁਸ਼ੀ ਉਸਾਹਤ ਜੀਵਨ ਜਸ਼ਨ ਦਾ ਪ੍ਰਗਟਾਵਾ ਇਹ ਕੀਤਾ ਵਿੱਚ ਕੰਮ ਕਰਨ ਤੋਂ ਬਾਅਦ ਆਰਾਮ ਅਤੇ ਖੁਸ਼ੀ ਮਨਾਉਣ ਦਾ ਇੱਕ ਤਰੀਕਾ ਹੈ ਸੱਭਿਆਚਾਰ ਪਹਿਚਾਣ ਇਹਦੀ ਇਹ ਹੈ ਕਿ ਪੰਜਾਬੀਆਂ ਦੀ ਮਿਹਨਤ ਲਚਕੀਲੇ

ਸਰੀਰ ਲਈ ਫਾਇਦੇਮੰਦ ਰਹਿੰਦੇ ਸਰੀਰ ਨੂੰ ਖੁਸ਼ੀ ਦਿੰਦਾ ਕਿਉਂਕਿ ਜਦੋਂ ਸਾਡੀ ਆਤਮਾ ਖੁਸ਼ ਹੁੰਦੀ ਹੈ ਸਾਡਾ ਸਰੀਰ ਵੀ ਤੰਦਰੁਸਤ ਆਪਣੇ ਆਪ ਹੋ ਜਾਂਦਾ ਤੇ ਮਨ ਵੀ ਇੱਕ ਪ੍ਰਫੁੱਲਤ ਮਹਿਸੂਸ ਕਰਦਾ ਹੈ ਪੰਜਾਬੀ ਸੰਗੀਤ ਦਾ ਪ੍ਰਚਾਰ ਭੰਗੜੇ ਰਾਹੀਂ ਹੀ ਹੁੰਦਾ ਹੈ ਕਿਉਂਕਿ ਭੰਗੜਾ ਪੰਜਾਬੀ ਤਿਹਾਰ ਦਾ ਅਨਿੱਖੜਵਾਂ ਅੰਗ ਹੈ ਲੋਕ ਵਿਸਾਖੀ ਦਿਵਾਲੀ ਲੋਹੜੀ ਅਤੇ ਹੋਰ ਤਿਉਹਾਰਾਂ ਨਾਲ ਭੰਗੜੇ ਦਾ ਆਨੰਦ ਲੈਂਦੇ ਹਨ ਭੰਗੜੇ ਨੇ ਨਾ ਫਿਰ ਪੰਜਾਬ ਸਗੋਂ ਦੁਨੀਆਂ ਭਰ ਵਿੱਚ ਵੀ ਇਕੱਠੇ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾਈ ਹ ਭੰਗੜਾ ਪੰਜਾਬੀ ਸੱਭਿਆਚਾਰ ਦਾ ਉਹ ਮਹੱਤਵਪੂਰਨ ਅਨਮੋਲ ਖਜ਼ਾਨਾ ਜੋ ਖੁਸ਼ੀ ਉਸਾਰ ਤੇ ਜੀਵਨ ਦੇ ਜਸ਼ਨ ਲਈ ਮਹੱਤਵਪੂਰਨ ਐ ਪੰਜਾਬੀ ਤਿਹਾਰ ਦਾ ਅਨਿਖੜਵਾਂ ਅੰਗ ਬਣ ਕੇ ਪੰਜਾਬੀ ਸੱਭਿਆਚਾਰ ਨੂੰ ਦੁਨੀਆ ਭਰ ਵਿੱਚ ਪ੍ਰਸਿੱਧ ਕਰ ਦਿੱਤਾ ਇਹ ਅੱਜ ਕੱਲ ਪੰਜਾ ਅਜੋਕੇ ਪਾਕਿਸਤਾਨ ਕਨੇਡਾ ਤੇ ਪੰਜਾਬ ਵਿੱਚ ਪਾਇਆ ਜਾਂਦਾ ਕਿਉਂਕਿ ਇਹ ਬਹੁਤ ਜਿਆਦਾ ਪ੍ਰਚਲਿਤ ਹੋ ਚੁੱਕਿਆ ਹੈ